ਹੈਲੋ ਸਰ ਅਸੀਂ ਲਾਈਟਾਂ ਫਿਕਸ ਕਰਾਉਣੀਆਂ ਸੀ ਘਰ 'ਚ ਬਿਜਲੀ ਦਾ ਕੰਮ ਕਰਾਉਣਾ ਸੀਗਾ ਅਤੇ ਤੁਸੀਂ ਲਾਈਟਾਂ ਸਰ ਕਰਾਉਣੀਆਂ ਸੀ ਫਿਕਸ ਅਤੇ ਮਤਲਬ ਮਤਲਬ ਲਾਈਟਾਂ ਹੈਗੀਆਂ ਨੇ ਉਹਦੀਆਂ ਹੈਗੀਆਂ ਨੇ ਕੋਲ ਜਿਵੇਂ ਤੁਹਾਡੇ ਕੋਲ ਲੈਣੀਆਂ ਨੇ ਅਤੇ ਕਿਉਂਕਿ ਜਦੋਂ ਘਰ ਢਾਹਿਆ ਸੀ ਪਿਛਲੀ ਵਾਰੀ ਉਦੋ ਉਦੋਂ ਜਿਹੜੀਆਂ ਲਾਈਟਾਂ ਸੀ ਉਹ ਸੀ ਰਿਜੂਸ ਕਰ ਸਕਦੇ ਹਾਂ ਅਤੇ ਬਾਕੀ ਜਿਹੜੀਆਂ ਨਵੀਆਂ ਵੀ ਕਿਉਂਕਿ ਜ਼ਿਆਦਾ ਲਵਾਉਣੀਆ ਉਦੋਂ ਘੱਟ ਸੀਗੀਆਂ ਲਾਈਟਾਂ ਅਤੇ ਉਹ ਅਸੀਂ ਫਿਕਸ ਕਰਾਉਣੀਆਂ ਨੇ ਅਤੇ ਤੁਸੀਂ ਕਿਸ ਹਿਸਾਬ ਨਾਲ ਮਤਲਬ ਦਿਹਾੜੀ 'ਤੇ ਕੰਮ ਕਰਦੇ ਹੋ ਕਿ ਠੇਕਾ ਮੁਕਾਉਂਦੇ ਹੋ ਸਰ ਕਸੀਲਡ ਲਾਈਟ ਜਿਹੜੀ ਲੈਂਟਰ ਦੇ ਅੰਦਰ ਫਿਕਸ ਨਹੀਂ ਹੋ ਜਾਂਦੀ ਮਤਲਵ ਕੋਂਬੀਮਨੇਸ਼ਨ ਕਲਰ ਕੋਂਮਬੀਨੇਸ਼ਨ ਦੇ ਹਿਸਾਬ ਨਾਲ ਜਿਵੇਂ ਪੇਂਟ ਕੀਤਾ ਹੁੰਦਾ ਉਹ ਹਿਸਾਬ ਨਾਲ ਲਾਈਟ ਨਾਲ ਡਾਰਕ ਡਾਰਕ ਨਾਲ ਲਾਈਟ ਕਲਰ ਉਹ ਹਿਸਾਬ ਨਾਲ ਸਾਰਾ ਅਲੱਗ ਅਲੱਗ ਮਤਲਬ ਸਾਰੇ ਘਰ 'ਚ ਇੱਕੋ ਰੰਗ ਨਹੀਂ ਲਵਾਉਣਾ ਸਰ ਇਹ ਤਾਂ ਤੁਸੀਂ ਬੰਦਾ ਭੇਜੋਗੇ ਨਾ ਦਿਹਾੜੀ ਵਾਲਾ ਦਿਹਾੜੀ ਵਾਲਾ ਕਿ ਲੇਬਰ ਜੋ ਵੀ ਹੈ ਅਤੇ ਉਹ ਚੈੱਕ ਕਰ ਲਏਗਾ ਜਿਸ ਹਿਸਾਬ ਨਾਲ ਪੁਆਇੰਟ ਲੱਗੇ ਹੋਣਗੇ ਨਾ ਉਹ ਹਿਸਾਬ ਨਾਲ ਤੁਸੀਂ ਵੇਖ ਲਿਓ ਜੀ ਅਤੇ ਕਿਸ ਕਿੰਨੇ ਸਕੇਅਰ ਫੁੱਟ ਦੇ ਹਿਸਾਬ ਨਾਲ ਸਰ ਤੁਸੀਂ ਲੈਂਦੇ ਹੋ ਕਿੱਦਾਂ ਆ ਦਿਹਾੜੀ 'ਤੇ ਅੱਛਾ ਮੈਂ ਫਿਰ ਵੀ ਸਰ ਰੇਟ ਤਾਂ ਮਤਲਬ ਰੇਟ ਜਾਇਜ਼ ਜਾਇਜ਼ ਲਾਇਆ ਜੀ ਸਰ

ਕਿਉਂਕਿ ਸਰ ਅਸੀਂ ਤੁਹਾਡਾ ਨਾਮ ਸੁਣਿਆ ਸ਼ਹਿਰ 'ਤੇ ਤੁਹਾਡਾ ਨਾਂ ਚੱਲਦਾ ਤਾਂ ਤੁਹਾਨੂੰ ਮੈਂ ਕਿਹਾ ਨਹੀਂ ਤਾਂ ਅਸੀਂ ਹੋਰ ਕਿਸੇ ਨੂੰ ਵੀ ਫੋਨ ਲਾਉਂਦੇ ਹੁੰਦੇ ਤੁਹਾਡਾ ਕੰਮ ਸੁਣਿਆ ਮੇਰੇ ਦੋ ਦੋਸਤ ਨੇ ਤੁਹਾਡੇ ਤੋਂ ਕੰਮ ਕਰਾਇਆ ਅਤੇ ਕੰਮ ਬਹੁਤ ਵਧੀਆ ਹੋਈਆਂ ਤਾਂ ਤਾਂ ਤੁਹਾਨੂੰ ਕਾਲ ਕੀਤੀ ਆ ਕਿਉਂਕਿ ਮੇਰੇ ਦੋਸਤ ਨੇ ਨੰਬਰ ਦਿੱਤਾ ਸੀਗਾ ਤੁਹਾਡਾ ਉਹ ਕਹਿੰਦਾ ਸੀ ਵੀ ਆ ਬੰਦੇ ਕੰਮ ਬੜਾ ਵਧੀਆ ਕਰਦੇ ਨੇ ਕੋਈ ਨਹੀਂ ਸਰ ਫਿਰ ਕਦੋਂ ਭੇਜੋਗੇ ਸਰ ਮੁੰਡਾ ਸਰ ਜਲਦੀ ਭੇਜ ਦਿਓ ਜੀ ਪਤਾ ਕੀ ਸਰ ਅੱਗੇ ਫਿਰ ਤੁਹਾਨੂੰ ਪਤਾ ਤਿਉਹਾਰ ਆਈ ਜਾਂਦੇ ਅਤੇ ਕੰਮ ਜਲਦੀ ਜਲਦੀ ਨਿਬੜੇ ਨਾ ਹੋਰ ਵੀ ਕੰਮ ਹੁੰਦਾ ਬਾਹਰ ਵੀ ਜਾਣਾ ਹੁੰਦਾ

ਅਤੇ ਸਰ ਤਾਰਾਂ ਵੀ ਮਤਲਬ ਚਾਹੀਦੀਆਂ ਹੋਣੀਆਂ ਜਿਵੇਂ ਇੱਕ ਐਮ ਐਮ ਦੀਆਂ ਆਉਂਦੀਆਂ ਆ ਜਿਵੇਂ ਵੀ ਇਹ ਤਾਰਾਂ ਤੂਰਾਂ ਬਟਨ ਬੁਟਨ ਸਰ ਫਿਟਿੰਗ ਮਤਲਬ ਫਿਟਿੰਗ ਵੀ ਕਰਾਉਣੀ ਹੈ ਨਾਲ ਕਿਉਕਿ ਉਹਨਾਂ ਨੇ ਢਾਹ ਕੇ ਬਣਾਇਆ ਸੀ ਨਾ ਨਵੀਂ ਕੋਠੀ ਪਾਈ ਆਪਾਂ ਉਹ ਵੀ ਕਰਾਉਣਾ ਹੂੰ ਰੇਟ ਸਰ ਲਾ ਜਾਇਜ਼ ਜਾਇਜ਼ ਲਿਓ ਜੀ ਕੋਈ ਨਹੀਂ ਸਰ ਆਏਂ ਕਰਿਓ ਜੀ ਸਰ ਫਿਰ ਕੱਲ੍ਹ ਆ ਜਾਇਓ ਜੀ ਅਤੇ ਕੱਲ੍ਹ ਤੁਸੀਂ ਵੇਖ ਲਿਓ ਜੀ ਹਿਸਾਬ ਨਾਲ ਫਿਰ ਠੇਕਾ ਮੁਕਾ ਜਾਇਓ ਜੀ ਕੱਲ੍ਹ ਆ ਜਾਇਓ ਜੀ ਘਰ ਆ ਜਾਇਓ ਹੈਂ ਕੋਈ ਗੱਲ ਨਹੀਂ ਫਿਰ ਆਪਾਂ ਰੇਟ ਲਾ ਲਵਾਂਗੇ ਜਿਵੇਂ ਵੀ ਹੈ ਨਾ ਕਰਲਾਂਗੇ ਸਰ ਓਕੇ ਸਰ ਥੈਂਕ ਯੂ